ਹਾਂਜੀ ਮੈਨੇ ਯੂਟੀਊਬ ਤੋਂ ਬਹੁਤ ਕੁਝ ਸਿੱਖਿਆ ਹੈ ਪਰ ਮੈਨੂੰ ਸਿਲਾਈ ਕਰਨ ਦਾ ਬਹੁਤ ਸ਼ੌਂਕ ਸ ਹੈ ਮੈਨੂੰ ਪਹਿਲਾਂ ਤਾਂ ਸਿੰਪਲ ਸੂਟ ਹੀ ਬਣਾਉਣੇ ਆਉਂਦੇ ਸੀ ਪਰ ਮੈਨੇ ਯੂਟੀਊਬ 'ਤੇ ਦਾ ਡਰੀਮ ਸਟਿਚਿੰਗ ਚੈਨਲ ਤੋਂ ਅਤੇ ਸਟਿਚ ਐਂਡ ਸਟਾਈਲ ਬਾਏ ਤਨੂੰ ਇਹਨਾਂ ਚੈਨਲਾਂ ਤੋਂ ਸਿੱਖ ਸਿੱਖ ਕੇ ਨਵੇਂ ਨਵੇਂ ਡਿਜ਼ਾਇਨ ਦੇ ਸੂਟ ਬਣਾਏ ਨੇ ਅਤੇ ਮੇਰੀ ਭਾਣਜੀ ਨੇ ਮੈਨੂੰ ਇੱਕ ਵੀਡੀਓ ਭੇਜੀ ਅਤੇ ਕਿਹਾ ਕਿ ਮਾਸੀ ਮੈਨੂੰ ਇੱਦਾਂ ਦਾ ਸੂਟ ਬਣਾ ਕੇ ਦੇ ਦਿਉ ਮੈਨੇ ਉਹ ਵੀਡੀਓ ਦੇਖੀ ਅਤੇ ਉਹਨੂੰ ਸੂਟ ਬਣਾ ਕੇ ਦਿੱਤੇ ਉਹਨੇ ਉਹ ਸੂਟ ਆਪਣੀ ਸਹੇਲੀਆਂ ਨੂੰ ਵੀ ਦਿਖਾਇਆ ਅਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਅਤੇ ਉਹਨਾਂ ਨੇ ਕਿਹਾ ਕਿ ਨਵਪ੍ਰੀਤ ਸਾਨੂੰ ਇੱਦਾਂ ਦਾ ਸੂਟ ਬਣਵਾ ਕੇ ਦੇ ਤੇਰੀ ਮਾਸੀ ਤੋਂ ਇੱਦਾਂ ਦਾ ਹੀ ਡਿਜ਼ਾਇਨ